ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਪਠਾਨਕੋਟ ਤੋਂ ਹਰਜੀਤ ਕੋਰ ਬੋਲ ਰਹੀ ਹਾਂ ਮੈਂ ਘਰ ਵਿੱਚ ਇੱਕ ਛੋਟਾ ਜਿਹਾ ਬੁਟੀਕ ਖੋਲ੍ਹਿਆ ਹੋਇਆ ਹੈ ਜਿਸ ਵਿੱਚ ਮਤਲਬ ਕਿ ਥੋ ਥੋੜ੍ਹੇ ਕਸਟਮਰ ਮੇਰੇ ਕੋਲ ਆ ਜਾਂਦੇ ਨੇ ਅਤੇ ਕੁਛ ਇਹਨਾਂ ਦੇ ਵਿੱਚ ਪ੍ਰ ਕੰਮ ਕਰਨ ਦੇ ਵਿੱਚ ਥੋੜ੍ਹੀ ਮੁਸ਼ਕਿਲਾਂ ਵੀ ਆਉਂਦੀਆਂ ਨੇ ਇਸ ਤਰ੍ਹਾਂ ਆਉਂਦੀਆਂ ਨੇ ਕਿ ਜਿਸ ਤਰ੍ਹਾਂ ਮਸ਼ੀਨ ਦੇ ਵਿੱਚ ਜਿਸ ਤਰ੍ਹਾਂ ਪਤਲਾ ਕੱਪੜਾ ਹੈ ਉਹਨੂੰ ਸਿਉਂਣਾ ਬਹੁਤ ਔਖਾ ਹੈ ਜਿਸ ਤਰ੍ਹਾਂ ਮੋਤੀਆਂ ਵਾਲੇ ਕੱਪੜੇ ਨੇ ਉਹਨਾਂ ਦੇ ਵਿੱਚ ਵੀ ਬੜੀ ਪ੍ਰੋਬਲਮ ਆਉਂਦੀ ਹੈ ਜਿਸ ਤਰ੍ਹਾਂ ਅਸੀਂ ਕੱਪੜੇ ਸਿਉਂਦੇ ਹਾਂ ਅਤੇ ਵਾਰ ਵਾਰ ਸੂਈ ਟੁੱਟ ਜਾਂਦੀ ਹੈ ਅਤੇ ਟੁੱਟਣ ਦੇ ਨਾਲ ਇਹ ਇਹਨਾਂ ਕੱਪੜਿਆਂ ਨੂੰ ਸਿਉਂਣਾ ਬਹੁਤ ਔਖਾ ਹੋ ਜਾਂਦਾ ਹਨ ਇੱਕ ਵਾਰ ਮੇਰੇ ਕੋਲ ਇੱਕ ਕਸਟਮਰ ਆਇਆ ਉਸਨੇ ਮੈਨੂੰ ਜੀਨ ਦਾ ਕੱਪੜਾ ਦੇ ਕੇ ਗਿਆ ਕਹਿੰਦਾ ਮੇਰੀ ਜੈਕਟ ਸਿਉਂਣੀ ਹੈ ਅਤੇ ਮ ਮਸ਼ੀਨ ਦੇ ਵਿੱਚ ਜਿਹੜੀ ਹਨ ਸੂ ਸੂਈਆਂ ਹੁੰਦੀਆਂ ਕੋਈ ਅਠਾਰਾਂ ਨੰਬਰ ਦੀ ਕੋਈ ਸੋਲ਼ਾਂ ਨੰਬਰ ਦੀ ਕੁਝ ਇਸ ਨੰਬਰ ਦੀ ਲੱਗੀ ਹੁੰਦੀ ਹੈ ਕਈ ਵਾਰ ਕੋਈ ਜੀਨ ਦੇ ਕੱਪੜੇ ਨੂੰ ਸਿਉਂਣਾ ਬਹੁਤ ਔਖਾ ਹੋ ਜਾਂਦਾ ਵਾਰ ਵਾਰ ਸੂਈਆਂ ਟੁੱਟ ਜਾਂਦੀਆਂ ਹਨ ਅਤੇ ਵਾਰ ਵਾਰ ਸੂਈਆਂ ਟੁੱਟ ਜਾਂਦੀਆਂ ਹਨ ਅਤੇ ਉਹ ਕ ਕੱਪੜਾ ਵੀ ਜਿਹੜਾ ਸਿਉਂਣਾ ਜਿਹੜਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਇਸ ਕਰਕੇ ਕੁਛ ਇਸ ਤਰ੍ਹਾਂ ਦੇ ਕੱਪੜੇ ਹੁੰਦੇ ਹਨ ਜਿਨ੍ਹਾਂ ਨੂੰ ਸਿਉਂਣਾ ਔਖਾ ਹੁੰਦਾ ਨੇ ਅਤੇ ਜਿਸ ਤਰ੍ਹਾਂ ਕੋਟਨ ਦਾ ਕੱਪੜਾ ਉਹਨੂੰ ਸਿਉਂਣਾ ਬਹੁਤ ਸੌਖਾ ਹੈ ਉਸਦੀ ਕੱਪੜੇ ਦੇ ਸਫਾਈ ਵੀ ਕਾਫ਼ੀ ਆਉਂਦੀ ਹੈ ਅਤੇ ਉਸ ਨੂੰ ਸਿਉਂਣਾ ਵੀ ਬਹੁਤ ਸੌਖਾ ਹੈ ਉਸਦੇ ਉਹ ਉਹਦੇ 'ਤੇ ਬੁਟੀਕ ਵਰਕ ਵੀ ਹੋਇਆ ਹੈ ਉਹ ਵੀ ਸਿਉਂਣਾ ਸੌਖਾ ਆ ਕਿਉਂਕਿ ਉਹਦੇ ਵਿੱਚ ਸੂਈ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਕੁਛ ਕੱਪੜੇ ਹਨ ਜਿਹਨਾਂ ਵਿੱਚ ਸੂਈਆਂ ਦੀ ਬਹੁਤ ਪ੍ਰੋਬਲਮ ਆਉਂਦੀ ਹੈ ਅਤੇ ਉਹਨਾਂ ਨੂੰ ਸਿਉਂਣਾ ਔਖਾ ਹੋ ਜਾਂਦਾ ਹੈ